ਮੈਨੂੰ ਸਕੂਲ ਵਿੱਚ ਪੜ੍ਹਨਾ ਅਤੇ ਟੀਚਰਾਂ ਨੂੰ ਪੜ੍ਹਾਉਂਦੇ ਵੇਖਣਾ ਬਹੁਤ ਵਧੀਆ ਲੱਗਦਾ ਹੁੰਦਾ ਸੀਗਾ ਜਿਹੜੇ ਸਾਡੇ ਸਕੂਲ ਦੇ ਟੀਚਰ ਹੁੰਦੇ ਸੀ ਸਾਨੂੰ ਬਹੁਤ ਵਧੀਆ ਤਰੀਕੇ ਨਾਲ ਪੜ੍ਹਾਉਂਦੇ ਹੁੰਦੇ ਸੀਗੇ ਕਿ ਜਿੱਦਾਂ ਉਹਨਾਂ ਨੂੰ ਆਪ ਵੀ ਬਹੁਤ ਪੜ੍ਹੇ ਲਿਖੇ ਹੁੰਦੇ ਸੀਗੇ ਕਿ ਜਿਹੜੇ ਅੱਗੇ ਸਾਨੂੰ ਗਾਈਡ ਕਰਨਾ ਨਾ ਉਹਨਾਂ ਨੂੰ ਸਾਰੀ ਕੁਲੀਫਿਕੇਸ਼ਨ ਦਾ ਉਹਨਾਂ ਦੀ ਵਧੀਆ ਹੁੰਦੀ ਸੀਗੀ ਕਿ ਜਿਹੜੀ ਸਾਨੂੰ ਜਿਹੜਾ ਉਹ ਪੜ੍ਹਾਉਣ 'ਚ ਐਨਾ ਵਧੀਆ ਪੜ੍ਹਾਉਂਦੇ ਹੁੰਦੇ ਸੀ ਕਿ ਸਾਨੂੰ ਉਹਨਾਂ ਦੀ ਇੱਕ ਇੱਕ ਗੱਲ ਕਹੀ ਹੋਈ ਜਿਹੜੀ ਹੈ ਬਹੁਤ ਵਧੀਆ ਤਰ੍ਹਾਂ ਸਮਝ ਆਉਂਦੀ ਹੁੰਦੀ ਸੀ ਆਪਾਂ ਉਹਨਾਂ ਕੋਲ ਬਹੁਤ ਹੀ ਬੜੇ ਪਿਆਰ ਨਾਲ ਪੜ੍ਹਦੇ ਹੁੰਦੇ ਸੀ ਉਹਨਾਂ ਦਾ ਪੜ੍ਹਾਉਣ ਦਾ ਤਰੀਕਾ ਵੀ ਬਹੁਤ ਵਧੀਆ ਹੁੰਦਾ ਸੀ ਸਾਰੀਆਂ ਬੁੱਕਸ ਪ੍ਰੋਵਾਈਡ ਹੁੰਦੀਆਂ ਸੀ ਸਾਨੂੰ ਸਕੂਲ ਵੱਲੋਂ ਹੈ ਨਾ ਅਤੇ ਜਿਸ ਤੋਂ ਅਸੀਂ ਦੇਖ ਕੇ ਪੜ੍ਹਦੇ ਹੁੰਦੇ ਸੀ ਅਤੇ ਜਿਹੜਾ ਇੱਕ ਸਿਲੇਬਸ ਸਰਕਾਰ ਵੱਲੋਂ ਦਿੱਤਾ ਜਾਂਦਾ ਸੀ ਜਿ ਜਿਹਨੂੰ ਦੇਖ ਦੇਖ ਕੇ ਟੀਚਰਸ ਪੜ੍ਹਾਉਂਦੇ ਹੁੰਦੇ ਸੀ ਕਿ ਕਿਹੜੇ ਮਹੀਨੇ 'ਚ ਕਿਹੜੇ ਸ ਕਿਹੜਾ ਬੁਕਸ ਦੀਆਂ ਕਿਹੜੀਆਂ ਕਿਹੜੇ ਲੈਸਨ ਕਰਵਾਉਣੇ ਹੈ ਹੈ ਨਾ ਇਹ ਸਾਰੀਆਂ ਚੀਜ਼ਾਂ ਉਹਨਾਂ ਨੂੰ ਦੱਸੀਆਂ ਹੁੰਦੀਆਂ ਸੀ ਅਤੇ ਉਹ ਸਾਨੂੰ ਇਸ ਤਰੀਕੇ ਨਾਲ ਪੜ੍ਹਾਉਂਦੇ ਹੁੰਦੇ ਸੀ ਬਹੁਤ ਵਧੀਆ ਪੜ੍ਹਾਉਂਦੇ ਹੁੰਦੇ ਸੀ ਅਤੇ ਉੱਥੋਂ ਦਾ ਜਿਹੜਾ ਮਾਹੌਲ ਸੀ ਉਹ ਵੀ ਬਹੁਤ ਵਧੀਆ ਸੀ ਜਿਹਨੂੰ ਦੇਖ ਕੇ ਦਿਲ ਹੀ ਕਰਦਾ ਸੀ ਸਕੂਲ ਦੇ ਮਾਹੌਲ ਨੂੰ ਦੇਖ ਕੇ ਪੜ੍ਹਨ ਨੂੰ ਬਹੁਤ ਦਿਲ ਕਰਦਾ ਹੁੰਦਾ ਸੀ ਅੱਜ ਕੱਲ੍ਹ ਦੇਖਿਆ ਜਾਵੇ ਤਾਂ ਟੀਚਰ ਦੀ ਕੁਆਲੀਫਿਕੇਸ਼ਨ ਹੁੰ ਹੁੰਦੀ ਤਾਂ ਹੈ ਟੀਚਰ ਵਧੀਆ ਪੜ੍ਹਿਆ ਹੁੰਦਾ ਐਜੂਕੇਟਡ ਹੁੰਦਾ ਬਟ ਜਿਹੜੇ ਟੀਚਰ ਸਰਕਾਰੀ ਨੌਕਰੀਆਂ ਵਾਲੇ ਹੈ ਉਹ ਬਹੁਤ ਘੱਟ ਜਿਹੜੀ ਆਪਣੀ ਐਨਰਜੀ ਵੇਸਟ ਕਰਦੇ ਨਿਆਣਿਆਂ 'ਤੇ ਜ਼ਿਆਦਾਤਰ ਪ੍ਰੋਜੈਕਟ ਆਨ ਕਰ ਦਿੰਦੇ ਹੈ ਪ੍ਰੋਜੈਕਟ 'ਤੇ ਕੁਸ਼ਚਨ ਆਨਸਰ ਲਗਾ ਦਿੱਤੇ ਜਾਂਦੇ ਹੈ ਅਤੇ ਜਿਹੜੇ ਬੱਚੇ ਆ ਉਹ ਕਾਪੀਆਂ 'ਤੇ ਲਿਖੀ ਜਾਂਦੇ ਆ ਬਸ ਅਤੇ ਕੋਈ ਇੱਕ ਅੱਧਾ ਟੀਚਰ ਹੁੰਦਾ ਜਿਹੜਾ ਉਹਨਾਂ ਨੂੰ ਕੁਸ਼ਚਨ ਆਨਸਰ ਉਹਨਾਂ ਨੂੰ ਲੈਸਨ ਸਮਝਾਉਂਦਾ ਹੁੰਦਾ ਸੀ ਪੜ੍ਹਾਉਂਦਾ ਹੁੰਦਾ ਸੀ ਜ਼ਿਆਦਾਤਰ ਤਾਂ ਬੱਚਿਆਂ ਨੂੰ ਹੀ ਕਿਹਾ ਜਾਂਦਾ ਸੀ ਕੋਈ ਗੱਲ ਨਹੀਂ ਲੈਸਨ ਫਿਰ ਪੜ੍ਹਾਇਆ ਜਾਊਗਾ ਤੁਸੀਂ ਬਸ ਆਪਣੇ ਕੁਸ਼ਚਨ ਆਨਸਰ ਕਰ ਲਉ ਆਪਣਾ ਸਿਲੇਬਸ ਪੂਰਾ ਕਰ ਲਉ ਤੁਹਾਡੇ ਪੇਪਰ ਆ ਰਹੇ ਹੈ ਪੇਪਰਾਂ ਦੀ ਤਿਆਰੀ ਕਰ ਲਉ ਜਦ ਨਿਆਣਿਆਂ ਨੂੰ ਪਤਾ ਹੀ ਨਹੀਂ ਹੋਣਾ ਕਿ ਹੈ ਨਾ ਕੀ ਹੈਗਾ ਉਸ ਲੈਸਨ 'ਚ ਕੀ ਨਹੀਂ ਹੈ ਤਾਂ ਉਹ ਕੁਸ਼ਚਨ ਆਨਸਰ ਕਿਵੇਂ ਲਰਨ ਕਰ ਲੂਗਾ ਜਿਹੜੇ ਸਾਡੇ ਸਮੇਂ ਦਾ ਮਾਹੌਲ ਸੀ ਉਸ ਸਮੇਂ ਦਾ ਮਤਲਬ ਬਹੁਤ ਵਧੀਆ ਪੜ੍ਹਾਇਆ ਜਾਂਦਾ ਸੀ ਕੁਸ਼ਚਨ ਆਨਸਰ ਵੀ ਸਮਝਾਏ ਜਾਂਦੇ ਸੀ ਲੈਸਨ ਸਮਝਾਏ ਜਾਂਦੇ ਸੀ ਹੁਣ ਤਾਂ ਅੱਜ ਕੱਲ੍ਹ ਬਹੁਤ ਘੱਟ ਹੀ ਟੀਚਰ ਇੱਦਾਂ ਦੇ ਹੋਣਗੇ ਜੋ ਬਹੁ ਬਹੁਤ ਵਧੀਆ ਤਰੀਕੇ ਨਾਲ ਪੜ੍ਹਾਉਂਦੇ ਹੋਣਗੇ ਕਿ ਸਾਰੇ ਹੀ ਬੱਚਿਆਂ ਨੂੰ ਨੌਲੇਜ ਦਿੰਦੇ ਹੋਣਗੇ ਕਿਹੜੇ ਲੈਸਨ 'ਚ ਕਿਵੇਂ ਹੈ ਹੈ ਨਾ ਬਾਕੀ ਹੋਰ ਵੀ ਚੀਜ਼ਾਂ ਦੀ ਜੀ ਕੇ ਦੀ ਉਹਨਾਂ ਨੂੰ ਨੌਲੇਜ ਦਿੰਦੇ ਹੋਣਗੇ ਸਾਰੀ ਨੌਲੇਜ ਦਿੰਦੇ ਹੋਣਗੇ ਜਿਸ ਨਾਲ ਬੱਚੇ ਨੂੰ ਵੀ ਵਧੀਆ ਲੱਗਦਾ ਹੋਊਗਾ ਪੜ੍ਹਨਾ ਵੀ ਇੰਟਰਸਟ ਦਿਖਾਉਂਦੇ ਹੋਣਗੇ ਕਦੇ ਕਦੇ ਗੇਮਸ ਖਿਡਵਾਉਂਦੇ ਹੁੰਦੇ ਸੀ ਸਾਡੇ ਟਾਈਮ 'ਤੇ ਤਾਂ ਟੀਚਰ ਜਿਸ ਨਾਲ ਬੱਚਾ ਬੋਰ ਵੀ ਨਹੀਂ ਸੀ ਹੁੰਦਾ ਹੈ ਨਾ ਕਿ ਆਪਾਂ ਸਾਰੇ ਟਾਈਮ ਪੜ੍ਹਦੇ ਹੀ ਰਹਿਣਾ ਇੱਕ ਅੱਧਾ ਪੀਰੀਅਡ ਖੇਡਣਾ ਵੀ ਹਾਫ ਟਾਈਮ ਜਦੋਂ ਹੁੰਦੀ ਹੈ ਉਹ ਤਾਂ ਚਲੋ ਆਪਾਂ ਵੀਹ ਮਿੰਟ ਦੀ ਹਾਫ ਟਾਈਮ ਹੁੰਦਾ ਸੀ ਸਾਨੂੰ ਉਹਦੇ ਵਿੱਚ ਆਪਾਂ ਲੰਚ ਵੀ ਕਰਨਾ ਕਿਹੜੇ ਟਾਈਮ ਆਪਾਂ ਖੇਡਣਾ ਹੁੰਦਾ ਸੀ ਅਤੇ ਫਿਰ ਸਾਨੂੰ ਇੱਕ ਪੀਰੀਅਡ ਗੇਮਸ ਪੀਰੀਅਡ ਦਿੱਤਾ ਜਾਂਦਾ ਸੀ ਫਿਜੀਕਲ ਦਾ ਜਿਹਦੇ ਵਿੱਚ ਅਸੀਂ ਖੇਡਦੇ ਹੁੰਦੇ ਸੀ ਜਦੋਂ ਵੱਡੀਆਂ ਕਲਾਸਾਂ 'ਚ ਆ ਗਏ ਉਦੋਂ ਫਿਜ਼ੀਕਲ ਹੁੰਦੀ ਨਹੀਂ ਸੀ ਸਾਨੂੰ ਅਤੇ ਫਿਰ ਅਸੀਂ ਸਾਨੂੰ ਉੱਦਾਂ ਹੀ ਇੱਕ ਪੀਰੀਅਡ ਦਿੱਤਾ ਜਾਂਦਾ ਸੀ ਜਿਹੜਾ ਸਾਡਾ ਫਰੀ ਹੁੰਦਾ ਸੀ ਜਾਂ ਕਿਸੇ ਦਿਨ ਟੀਚਰ ਨਾ ਹ ਆਏ ਹੋਣ ਤਾਂ ਉਦਣ ਅਸੀਂ ਉਸ ਪੀਰੀਅਡ 'ਚ ਬਹੁਤ ਇੰਜੋਏ ਕਰਦੇ ਹੁੰਦੇ ਸੀ ਨਾਲੇ ਦਿਲ ਵੀ ਬਹੁਤ ਵਧੀਆ ਲੱਗਦਾ ਹੁੰਦਾ ਸੀ ਪੜ੍ਹਾਈ 'ਚ ਇੱਦਾਂ ਅੱਜ ਕੱਲ੍ਹ ਦੇ ਟੀਚਰਾਂ ਦਾ ਪੜ੍ਹਾਉਣ ਦਾ ਤਰੀਕਾ ਹੁੰਦਾ ਸੀ